ਹੈਲੋ ਹੈਲੋ ਜਨਾਬ ਮੈਂ ਇੱਕ ਬੈਡਸ਼ੀਟ ਆਡਰ ਕੀਤੀ ਸੀ ਤੁਹਾਡੀ ਵੈੱਬਸਾਈਟ ਤੋਂ ਹਾਂ ਲਗਭਗ ਦਸ ਦਿਨ ਪਹਿਲਾਂ ਦੀ ਗੱਲ ਆ ਉਸ ਸੰਬੰਧ ਵਿੱਚ ਇੱਕ ਕੰਪਲੇਂਟ ਹੈਗੀ ਆ ਹਾਂ ਦੱਸਦਾ ਮੈਂ ਤੁਹਾਨੂੰ ਕੰਪਲੇਂਟ ਮੇਰੀ ਗੱਲ ਸੁਣੋ ਵੀ ਮੈਂ ਤੁਹਾਨੂੰ ਆਰਡਰ ਦਿੱਤਾ ਸੀ ਦਸ ਦਿਨ ਪਹਿਲਾਂ ਅਤੇ ਟਰਮਸ ਐਂਡ ਕੰਡੀਸ਼ਨ ਜੋ ਲਿਖੀਆਂ ਹੋਈਆਂ ਸੀ ਉਹਦੇ ਮੁਤਾਬਕ ਤੁਸੀਂ ਡਿਲੀਵਰੀ ਦੇਣੀ ਸੀ ਵਿਧਇੰਨ ਥ੍ਰੀ ਡੇਜ਼ ਪਹਿਲੀ ਗੱਲ ਡਿਲੀਵਰੀ ਸਾਨੂੰ ਲੇਟ ਮਿਲੀ ਤਿੰਨ ਦੀ ਬਜਾਏ ਪੰਜ ਦਿਨ ਲੱਗੇ ਚਲੋ ਨੌ ਪ੍ਰੋਬਲਮ ਦੋ ਦਿਨ ਐਕਸਟਰਾ ਲੱਗ ਗਏ ਕੋਈ ਚੱਕਰ ਨਹੀਂ ਹੈਗਾ ਪਰ ਹੁਣ ਮੇਨ ਜਿਹੜੀ ਕੰਪਲੇਂਟ ਮੈਂ ਤੁਹਾਨੂੰ ਕਰਨ ਲੱਗਾ ਉਹ ਇਹ ਆ ਕੁਆਲਿਟੀ ਬੈਡਸ਼ੀਟ ਦੀ ਜੋ ਤੁਸੀਂ ਕੁਆਲਿਟੀ ਐਡਵਰਟਾਈਜ ਕਰਦੇ ਪਏ ਸੀ ਆਪਣੀ ਸਾਈਟ 'ਤੇ ਸ਼ੋਅ ਕਰਦੇ ਪਏ ਸੀ ਡੈਮੋ ਦੇ ਰਹੇ ਸੀਗੇ ਉਹਦੇ ਕੰਪੈਰਟਿਵਲੀ ਅਗਰ ਉਹਨੂੰ ਕੰਪੀ ਦੇਖੀਏ ਤਾਂ ਉਹ ਫਿਫਟੀ ਪ੍ਰਸੈਂਟ ਵੀ ਨਹੀਂ ਹੈਗੀ ਪਹਿਲੀ ਗੱਲ ਤਾਂ ਕਲਰ ਹੀ ਥੋੜ੍ਹਾ ਜਿਹਾ ਜੋ ਸਾਈਟ 'ਤੇ ਤੁਸੀਂ ਵਿਖਾਇਆ ਸੀਗਾ ਉਹ ਹੈ ਹੀ ਨਹੀਂ ਹੈ ਉੱਥੇ ਸੀਗਾ ਗ੍ਰੇ ਕਲਰ ਤਕਰੀਬਨ ਬਲੈਕ ਟੋਨ ਦੇ ਵਿੱਚ ਅਤੇ ਉਹ ਨਿਕਲੀ ਆ ਬਲੂ ਕਲਰ ਗ੍ਰੇ ਅਤੇ ਬਲੂ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਤੁਹਾਨੂੰ ਪਤਾ ਨਹੀਂ ਨਜ਼ਰ ਆਉਂਦਾ ਕਿ ਨਹੀਂ ਆਉਂਦਾ ਫਰਕ ਪਰ ਮੈਨੂੰ ਤਾਂ ਕਲਰ ਦਾ ਫਰਕ ਨਜ਼ਰ ਆਉਂਦਾ ਵਾ ਬਾਕੀ ਡਿਜ਼ਾਇਨ ਵੀ ਮੰਗਵਾਇਆ ਕੋਈ ਅਤੇ ਭੇਜਿਆ ਕੋਈ ਨਾਲ ਤੁਸੀਂ ਸਿਰਹਾਣੇ ਦੇ ਗਿਲਾਫ ਵੀ ਲਿਖੇ ਦੇ ਸੀ ਉਹ ਵਿੱਚ ਹੈ ਹੀ ਨਹੀਂ ਚਾਹੁੰਦਾ ਕੀ ਹਾਂ ਮੈਂ ਸੁਣ ਲਓ ਪਹਿਲੀ ਗੱਲ ਤਾਂ ਇਹ ਆ ਕਿ ਮੈਂ ਉਹ ਤੁਹਾਨੂੰ ਵਾਪਸ ਕਰਨੀ ਆ ਅਤੇ ਤੁਸੀਂ ਰਿਫੰਡ ਕਰ ਦਿਓ ਅਲਟਰਨੇਟਿਵ ਹੋ ਰਿਹਾ ਇਹੋ ਹੀ ਹੋ ਸਕਦਾ ਵਾ ਵੀ ਤੁਸੀਂ ਜੋ ਐਡਵਰਟਾਈਜਮੈਂਟ ਦਿੱਤੀ ਸੀਗੀ ਉਹਦੇ ਨਾਲ ਅਗਰ ਪੈਰਲਲ ਉਹਦੇ ਇਕੁਅਲ ਅਗਰ ਕੋਈ ਚੀਜ਼ ਤੁਹਾਡੇ ਕੋਲ ਹੈਗੀ ਆ ਤਾਂ ਫੇਰ ਤੁਸੀਂ ਨਵੀਂ ਆਈਟਮ ਮੈਨੂੰ ਭੇਜ ਦਿਓ ਅਤੇ ਮੈਂ ਉਹ ਰਿਟਰਨ ਕਰ ਦਿੰਦਾ ਤੁਹਾਨੂੰ ਅਦਰਵਾਈਜ਼ ਜੋ ਤੁਹਾਨੂੰ ਪੇਮੈਂਟ ਕੀਤੀ ਹੋਈ ਆ ਚਾਰ ਸੌ ਰੁਪਏ ਦੀ ਪੇਮੈਂਟ ਸੀਗੀ ਉਹ ਤੁਸੀਂ ਰਿਫੰਡ ਕਰ ਦਿਓ ਹਾਂ ਹਾਂ ਤੁਸੀਂ ਚੈੱਕ ਕਰੋ ਅਤੇ ਜਲਦੀ ਤੋਂ ਜਲਦੀ ਇਹਦਾ ਕੋਈ ਨਾ ਕੋਈ ਸਲਿਊਸ਼ਨ ਮੈਨੂੰ ਦੇ ਦਿਓ ਠੀਕ ਹੈ ਜੀ ਓਕੇ ਓਕੇ ਓਕੇ